ਮੈਂ ਸਰੀਰ ਨੂੰ ਫਿੱਟ ਰੱਖਣ ਲਈ ਸਵੇਰੇ ਸਮੇਂ ਇੱਕ ਘੰਟੇ ਦੀ ਸੈਰ ਕਰਦਾ ਅਤੇ ਦੌੜ ਵੀ ਲਾਉਂਂਦਾ ਅਤੇ ਉਸਤੋਂ ਬਾਅਦ ਮੈਂ ਖੇਤਾਂ ਵਿੱਚ ਜਾ ਕੇ ਵੀ ਕਸਰਤ ਕਰਦਾ ਕੰਮ ਕਰਦਾ ਖੇਤਾਂ ਦਾ ਅਤੇ ਇਸ ਤਰ੍ਹਾਂ ਹੀ ਸ਼ਾਮ ਨੂੰ ਵੀ ਕਸ ਕਸਰ ਵੀ ਕਰਦਾ ਅਤੇ ਦੌੜ ਵੀ ਲਾਉਂਦਾ ਅਤੇ ਸੈਰ ਵੀ ਕਰਦਾ ਇੱਕ ਘੰਟੇ ਦੀ ਸਰੀਰ ਇਸ ਕਾਰਨ ਅਤੇ ਤਕੜਾ ਵੀ ਰਹਿੰਦਾ ਅਤੇ ਤਾਕਤ ਵੀ ਆਉਂਦੀ ਆ ਫਿੱਟ ਵੀ ਰਹਿੰਦਾ ਅਤੇ ਬਿਮਾਰੀਆਂ ਤੋਂ ਵੀ ਦੂਰ ਰਹਿੰਦਾ ਕੋਈ ਇਸ ਕਰਕਾ ਕੋਈ ਬੀ ਪੀ ਵੱਧਣ ਵੱਧ ਵੱਧਦਾ ਵੀ ਨਹੀਂ ਹੈ ਅਤੇ ਭੁੱਖ ਵੀ ਕਸਰਤ ਕਰਨ ਨਾਲ ਲੱਗਦੀ ਹੈ